ਅੱਜ ਕੱਲ੍ਹ ਦਾ ਜੋ ਮੀਡੀਆ ਨਿਊਜ਼ ਮੀਡੀਆ ਤੁਹਾਨੂੰ ਵੀ ਸਭ ਨੂੰ ਪਤਾ ਵੀ ਇਹ ਹਮੇਸ਼ਾ ਹੀ ਪੱਖਪਾਤ ਕਰਨ ਦੇ ਵਿੱਚ ਅੱਗੇ ਰਿਹਾ ਜਦੋਂ ਅਸੀਂ ਛੋਟੇ ਹੁੰਦੇ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਮੈਂ ਵੇਖਿਆ ਵੀ ਖ਼ਬਰਾਂ ਸੁਣਨ ਦੇ ਵਿੱਚ ਵੀ ਬੜਾ ਵਧੀਆ ਲੱਗਦਾ ਸੀ ਕਿਉਂਕਿ ਜਾਂ ਤਾਂ ਉਸ ਟੈਮ ਸਾਡਾ ਦਿਮਾਗ ਨਹੀਂ ਇੰਨਾ ਕੰਮ ਕਰਦਾ ਸੀ ਜਾਂ ਉਸ ਟੈਮ ਜੋ ਖ਼ਬਰਾਂ ਹੁੰਦੀਆਂ ਸੀ ਉਹ ਬਿਨਾਂ ਕਿਸੇ ਪੱਖਪਾਤ ਕੀਤੇ ਕਿਸੇ ਇੰਡਸਟ੍ਰੀ ਕਿਸੇ ਨੇਤਾ ਦੇ ਪੱਖਪਾਤ ਕੀਤੇ ਸੁਣਾਈਆਂ ਜਾਂਦੀਆਂ ਸੀ ਉਸ ਵਿੱਚ ਦੇਸ਼ ਪ੍ਰਤੀ ਭਾਵਨਾਵਾਂ ਖ਼ਬਰਾਂ ਸੁਣਾਉਣ 'ਚ ਜ਼ਿਆਦਾ ਹੁੰਦੀ ਸੀ ਅੱਜ ਕੱਲ੍ਹ ਦੀ ਮੀਡੀਆ ਵਿੱਚ ਇਹ ਚੀਜ਼ ਖ਼ਤਮ ਹੋ ਗਈ ਹੈ ਮੈਂ ਚਾਹੁੰਦਾ ਵੀ ਜੋ ਮੀਡੀਆ ਜੋ ਨਿਊਜ਼ ਮੀਡੀਆ ਹੈ ਖ਼ਬਰਾਂ ਦੀ ਕਵਰੇਜ ਹੈ ਉਹ ਬਿਲਕੁਲ ਨਿਰਪੱਖ ਹੋ ਕੇ ਕੀਤੀ ਜਾਵੇ ਤਾਂ ਕਿ ਜੋ ਅੱਜ ਕੱਲ੍ਹ ਦੀ ਯੂਥ ਹੈ ਉਸ ਨੂੰ ਚੰਗੀ ਜਾਗਰੂਕਤਾ ਮਿਲੇ